ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾ ਬੈਗ ਗੁੰਮ ਗਿਆ ਸੱਤ ਫੇਸ 'ਚ ਹਾਂਜੀ ਮੈਂ ਮਾਰਕੀਟ 'ਚ ਗਈ ਸੀ ਔਰ ਮੋਢੇ ਚੁੱਕਣ ਵਾਲਾ ਬੈਗ ਹੈ ਉਹਦੇ ਵਿੱਚ ਮੇਰੇ ਡਾਕੂਮੈਂਟ ਸੀ ਅਤੇ ਪਾਸਪੋਰਟ ਵਗੈਰਾ ਏ ਟੀ ਐੱਮ ਕਾਰਡ ਵਗੈਰਾ ਕੈਸ਼ ਥੋੜ੍ਹੇ ਜਿਹੇ ਪੈਸੇ ਸੀ ਸੱਤ ਪੰਜ ਸੱਤ ਸੌ ਰੁਪਇਆ ਨਹੀਂ ਆਮ ਬੈਗ ਹੈ ਮੋਢੇ 'ਤੇ ਚੁੱਕਣ ਵਾਲਾ ਤਾਂ ਨਹੀਂ ਹਾਂਜੀ ਹਾਂਜੀ ਮੈਂ ਆਪਣੇ ਘਰ ਪਹੁੰਚ ਗਈ ਹਾਂ ਹੁਣ ਤਾਂ ਸੌਲ੍ਹਾਂ ਸੌ ਪਚਾਸੀ ਸੈਕਟਰ ਸੱਤਰ ਹਾਂਜੀ ਉਸ 'ਤੇ ਹੀ ਚੱਲ ਰਿਹਾ ਔਰ ਜਲਦੀ ਤੋਂ ਜਲਦੀ ਮੇਰਾ ਲੱਭ ਦਿਓ ਬੈਗ ਲੈ ਕੇ ਜਾਣਾ ਸੀ ਬਾਹਰ ਹਾਂਜੀ ਹਾਂਜੀ ਓਕੇ ਬਸ ਚੰਗਾ ਜੀ ਸਤਿ ਸ਼੍ਰੀ ਅਕਾਲ